ਹੈਲੋ ਹੈਲੋ ਹਾਂਜੀ ਅਮਨਦੀਪ ਬੋਲਦੇ ਓ ਜੀ ਕੈਬ ਡ੍ਰਾਈਵਰ ਹਾਂ ਸਰ ਆਪਾਂ ਪਹਿਲਾਂ ਵੀ ਗਏ ਆਂ ਥੋਨੂੰ ਯਾਦ ਆ ਇੱਕ ਵਾਰੀ ਆਪਾਂ ਚੰਡੀਗੜ੍ਹ ਗਏ ਸੀਗੇ ਚਾਰ ਕ ਮਹੀਨੇ ਪਹਿਲਾਂ ਹਾਂ ਹਾਂ ਯਾਦ ਆ ਗਿਆ ਨਾ ਹਾਂ ਤੇ ਹੁਣ ਆਪਾਂ ਦੁਆਰਾ ਜਾਣਾ ਜੀ ਆਪਾਂ ਲੁਧਿਆਣੇ ਜਾਣਾ ਦੁਆਰਾ ਬਸ ਉਹ ਤਾਂ ਪ੍ਰੋਗਰਾਮ ਬਣਦਾ ਮੈਂ ਤੁਹਾਨੂੰ ਸ਼ਾਮ ਤੱਕ ਦੱਸਦਾ ਅੱਜ ਆਪਾਂ ਤੇ ਗੱਡੀ ਠੀਕ ਐ ਹੁਣ ਥੋਡੇ ਕੋਲੇ ਬਦਲ ਲੀ ਕਿ ਉਹੀ ਐ ਅੱਛਾ ਅੱਛਾ ਤੇ ਸਰ ਨਾ ਉਸ ਦਿਨ ਤੁਹਾਡੀ ਨਾ ਕੁਛ ਡਰਾਈਵਰੀ ਸਹੀ ਨੀ ਸੀਗੀ ਨਹੀਂ ਸੀਗੀ ਤੁਸੀਂ ਕੋਈ ਸਾਈਨ ਬੋਰਡ ਨੀ ਦੇਖ ਰਹੇ ਸੀਗੇ ਕੇ ਕਿੱਥੇ ਨੂੰ ਸੱਠ ਦੀ ਸਪੀਡ ਤੇ ਚਲਾਉਣਾ ਐ ਓਥੇ ਹੁਣ ਤੁਸੀਂ ਖਿੱਚੀ ਜਾਂਦੇ ਸੀ ਅੱਸੀ ਤੇ ਵੀ ਕਈ ਵਰੀ ਆਪਣਾ ਵੇਖਲੋ ਚਲਾਣ ਵੀ ਹੁੰਦਾ ਹੁੰਦਾ ਬਚਿਆ ਤੇ ਇੱਕ ਵਾਰੀ ਤੁਹਾਨੂੰ ਜਿਵੇਂ ਮਤਲਬ ਬਸ ਐਤਕਾਂ ਡਰਾਈਵਰੀ ਸਹੀ ਕਰ ਲਿਆ ਜੇ ਆਪਣੀ ਠੀਕ ਐ ਤੇ ਉਹ ਮੈਂ ਵੀ ਕਿਹਾ ਚਲ ਨਵੇਂ ਬੰਦੇ ਨਾਲ ਕੀ ਹੁਣ ਤੁਹਾਡੇ ਨਾਲ ਤਾਂ ਆਪਾਂ ਚਲੋ ਪਹਿਲਾਂ ਵੀ ਜਾਂਦੇ ਰਹਿੰਨੇ ਆਂ ਤੇ ਵੀ ਕੋਈ ਗੱਲ ਨੀ ਚਲ ਪੁਰਾਣੇ ਬੰਦੇ ਨਾਲ ਫੇਰ ਵੀ ਚਲੋ ਗੱਲਾਂ ਬਾਤਾਂ ਖੁੱਲੀਆਂ ਹੁੰਦੀਆਂ ਤੇ ਪੇਮੈਂਟ ਵਗੈਰਾ ਦਾ ਕੀ ਅੱਜ ਕੱਲ ਸਿਸਟਮ ਕਿੰਨੀ ਲੈ ਰਹੇ ਓ ਕਿਲੋਮੀਟਰ ਦੀ ਹਾਂ ਤੁਸੀਂ ਸੱਤ ਈ ਲਏ ਸੀ ਉਦੋਂ ਵੀ ਮੇਰੇ ਕੋਲੋਂ ਸੱਤ ਈ ਲਏ ਸੀਗੇ ਪੇਮੈਂਟ ਫੇਰ ਪੇਮੈਂਟ ਤਰੀਕਾ ਫੇਰ ਕੀ ਕੈਸ਼ ਹੀ ਲਾਓਂਗੇ ਕਿ ਔਨਲਾਈਨ ਵੀ ਲੈ ਲੋਂਗੇ ਫੇਰ ਅੱਧੀ ਤਾਂ ਮੈਂ ਅਡਵਾਂਸ ਕਰ ਦਿਆਂਗਾ ਹੁਣੇ ਈ ਅੱਜ ਹੀ ਅੱਜ ਈ ਅੱਧੀ ਅਡਵਾਂਸ ਕਰ ਦਿਆਂਗਾ ਕਿਲੋਮੀਟਰ ਦੇ ਸਾਬ ਨਾਲ ਜੋ ਵੀ ਬਣਦਾ ਢਾਈ ਕ ਸੌ ਕਿਲੋਮੀਟਰ ਹੋਏਗਾ ਸਾਈਡ ਦਾ ਤੇ ਪੰਜ ਸੌ ਪੰਜ ਸੌ ਕਿਲੋਮੀਟਰ ਬਣ ਜੂਗਾ ਦੋਨੋਂ ਸਾਈਡ ਦਾ ਹਾਂਜੀ ਤੇ ਹਾਂ ਅੱਧੀ ਤਾਂ ਮੈਂ ਅੱਜ ਕਰ ਦਿਆਂ ਕੋਈ ਗੱਲ ਨੀ ਤੁਹਾਨੂੰ ਤੇ ਅੱਛਾ ਉਹ ਸੱਤ ਸੱਤ ਰੁਪਏ ਤੋਂ ਉੱਪਰ ਐ ਪਲੱਸ ਐ ਹੈਂਅ ਅੱਛਾ ਚਲੋ ਫੇਰ ਕੋਈ ਨੀ ਫੇਰ ਕਰਲਾਂਗੇ ਹਾਂ ਜਿੰਨੇ ਵੀ ਟੋਲ ਟੈਕਸ ਪੈਣਗੇ ਫੇਰ ਉਹ ਕੋਈ ਗੱਲ ਨੀ ਜੀ ਕਰ ਲਵਾਂਗੇ ਤੇ ਦਸ ਰੁਪਏ ਤੋਂ ਤਾਂ ਥੱਲੇ ਥੱਲੇ ਪੈ ਜੂਗੀ ਨਾ ਕੋਈ ਨੀ ਦੋ ਹਜਾਰ ਰੁਪਇਆ ਮੈਂ ਅਡਵਾਂਸ ਕਰ ਦਿਆਂਗਾ ਹਾਂ ਹਾਂ ਡੇਟ ਵੀ ਅੱਜ ਹੀ ਡਿਸਾਈਡ ਕਰਲਾਂਗਾ ਜੀ ਬਸ ਪ੍ਰੋਗਰਾਮ ਬਣਦਾ ਐ ਤੇ ਦੋ ਹਜਾਰ ਰੁਪਈਆ ਸੁਆਰੀਆਂ ਫੇਰ ਇੱਕ ਮੈਂ ਜਾਂ ਇੱਕ ਮੇਰਾ ਕੋਈ ਫਰੈਂਡ ਹੋਏਗਾ ਦੋ ਜਣੇ ਹੋਵਾਂਗੇ ਅਸੀਂ ਹਾਂਜੀ ਹਾਂਜੀ ਕੋਈ ਗੱਲ ਨੀ ਜੀ ਤੇ ਅੱਛਾ ਅੱਛਾ ਕੋਈ ਗੱਲ ਨੀ ਸਰ ਕੋਈ ਗੱਲ ਨੀ ਮੈਂ ਅੱਜ ਡੇਟ ਵਗੈਰਾ ਦਾ ਸਾਰਾ ਤੁਹਾਨੂੰ ਕੰਫਰਮ ਕਰ ਦੇਊਂਗਾ ਮੈਂ ਗੂਗਲ ਪੇਅ ਮੈਂ ਹਾਫ ਪੇਮੈਂਟ ਕਰ ਦਿੰਦਾ ਹੁਣੇ ਤੇ ਉਸ ਤੋਂ ਬਾਦ ਜਿਹੜੀ ਰਹਿੰਦੀ ਪੇਮੈਂਟ ਵੇਖਲਾਂਗੇ ਫੇਰ ਆਪਾਂ ਜੇ ਕੈਸ਼ ਹੋਇਆ ਤਾਂ ਕੈਸ਼ ਕਰਲਾਂਗੇ ਮੌਕੇ ਤੇ ਈ ਨਹੀਂ ਤਾਂ ਫਿਰ ਨਹੀਂ ਤਾਂ ਫੇਰ ਉਹ ਵੀ ਆਪਾਂ ਜਿਹੜਾ ਕੀ ਆ ਠੀਕ ਐ ਸਰ ਜੀ ਓਕੇ ਜੀ ਨੰਬਰ ਮੇਰੇ ਕੋਲ ਹੈਗਾ ਤੁਹਾਡਾ ਮੈਂ ਕੌਲ ਕਰਲਾਂਗਾ